ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਤੁਹਾਡੀ ਏਜ ਅਤੇ ਹਾਈਟ ਕਿੰਨੀ ਹੈ ਓਕੇ ਓਕੇ ਅਤੇ ਤੁਹਾਡੀ ਡਾਇਟ ਪਲਾਨ ਦੇ ਵਿੱਚ ਤੁਹਾਡਾ ਰੂਟੀਨ ਕੀ ਹੈਗਾ ਮਤਲਬ ਤੁਹਾਡਾ ਖਾਣਾ ਪੀਣਾ ਕਿੱਦਾਂ ਚੱਲਦਾ ਅੱਛਾ ਜੀ ਅਤੇ ਚਲੋ ਮੈਂ ਫਿਰ ਡਾਇਟ ਦਾ ਦੱਸ ਦਿੰਨਾ ਤੁਹਾਨੂੰ ਦੇਖੋ ਸਵੇਰੇ ਖਾਣਾ ਆਪਾਂ ਉਠਦੇ ਸਾਰ ਦਲੀਆ ਦਲੀਆ ਵਗੈਰਾ ਲਾਈਟ ਫੂਡ ਖਾਣਾ ਠੀਕ ਹੈ ਠੀਕ ਹੈ ਅਤੇ ਗਿਆਰਾਂ ਕੁ ਵਜੇ ਆਪਾਂ ਜੂਸ ਵਗੈਰਾ ਪੀ ਕੇ ਨਾਲ ਆਪਣੇ ਡਰਾਈ ਫਰੂਟਸ ਹੋ ਗਏ ਠੀਕ ਹੈ ਅਤੇ ਨਾਲ ਬਨਾਨਾ ਸ਼ੇਕ ਹੋ ਗਿਆ ਸ਼ੇਕਸ ਵਗੈਰਾ ਆਪਾਂ ਜ਼ਿਆਦਾ ਪੀਣੇ ਹੈ ਠੀਕ ਹੈ ਤੇ ਦੁਪਹਿਰੇ ਆਪਾਂ ਖਾਣਾ ਰੱਜਵੀਂ ਰੋਟੀ ਜਿੱਦਾਂ ਮਰਜੀ ਠੀਕ ਹੈ ਜਦੋਂ ਤੁਸੀਂ ਖਾ ਸਕਦੇ ਹੋ ਆਰਾਮ ਨਾਲ ਆਪਣਾ ਸਾਰਾ ਕੈਲੋਰੀਜ਼ ਵਗੈਰਾ ਖਾਣੀ ਆ ਫੈਟ ਠੀਕ ਹੈ ਕਾਰਬਜ਼ ਖਾਣੇ ਆ ਇਹ ਕਾਰਬਜ਼ ਆਪਾਂ ਚਾਰ ਵਜੇ ਦੇ ਨੇੜੇ ਚਾਰ ਪੰਜ ਵਜੇ ਦੇ ਨੇੜੇ ਤੇੜੇ ਠੀਕ ਹੈ ਅਤੇ ਜਦੋਂ ਫਿਰ ਟਾਈਮ ਮਿਲਿਆ ਤਾਂ ਆਪਾਂ ਫਿਰ ਐਕਸਰਸਾਈਜ਼ ਵੀ ਕਰਨੀ ਆ ਜਦੋਂ ਤੁਸੀਂ ਜਿੰਮ ਜੁਆਇਨ ਕਰੋਗੇ ਫਿਰ ਆਪਾਂ ਐਕਸਰਸਾਈਜ਼ ਦਾ ਰੂਟੀਨ ਵੀ ਤੁਹਾਡਾ ਸੈੱਟ ਕਰ ਦਿਆਂਗੇ ਠੀਕ ਹੈ ਤੁਹਾਡਾ ਤੁਹਾਡੀ ਸ਼ੇਪ ਦੇ ਨਾਲ ਘਰ ਫਿਟਨੈਸ ਤਾਂ ਵਰਕਿੰਗ ਲਈ ਐਕਸਰਸਾਈਜ਼ ਜੇ ਘਰ ਆਪਾਂ ਕਰਨੀ ਆ ਤਾਂ ਫਿਰ ਬਸ ਪੁਸ਼ ਅਪ ਲਗਾ ਲਓ ਠੀਕ ਹੈ ਪਲੈਨਕ ਪਲੈਨਕ ਹੋ ਗਏ ਅਤੇ ਆਪਣੀ ਸਾਈਡ ਰੇਜ਼ ਹੋ ਗਈਆਂ ਠੀਕ ਹੈ ਅਤੇ ਪੁਲ ਅਪਸ ਵਗੈਰਾ ਹੋਗੇ ਹੋਰ ਮੇਨ ਮੇਨ ਜਿਹੜੀ ਬੋਡੀ ਲਈ ਆਪਣੀ ਫਲੈਕਸੀਬਿਲਿਟੀ ਸੈੱਟ ਕਰਦੀਆਂ ਨੇ ਉਹ ਹੀ ਰੱਖਣੀਆਂ ਆਪਾਂ ਜ਼ਿਆਦਾ ਇੰਟੈਂਨਸ ਵਰਕਆਊਟ ਕਰਾਂਗੇ ਫਿਰ ਆਪਣਾ ਵੇਟ ਲੋਸ ਹੋਣ ਦਾ ਜ਼ਿਆਦਾ ਚਾਸਿੰਸ ਹੋ ਜਾਣਗੇ ਤਾਂ ਆਪਾਂ ਤਾਂ ਬਲਕ ਕਰਨਾ ਨਾ ਹੁਣ ਨਹੀਂ ਇਹ ਆਪਣੀ ਇੰਡੋਰੈਂਸ ਵਧਾਉਂਦਾ

ਸਟੈਮੀਨਾ ਇੰਨਕ੍ਰੀਜ਼ ਕਰਦਾ ਇੰਡੋਰੈਂਸ ਵਧਾਉਂਦਾ ਆਪਣੀ ਪਾਚਨ ਕਿਰਿਆ ਸੈੱਟ ਕਰਦਾ ਸਾਰਾ ਕੁਛ ਕਰਦਾ

ਦੇਸੀ ਡਾਈਟ ਬਸ ਘਰ ਦਾ ਖਾਣਾ ਪੀਣਾ ਹੀ ਆ ਦੇਸੀ ਘਿਓ ਰੱਜ ਕੇ ਖਾਓ ਨਾਲ ਸਾਰਾ ਕੁਝ ਜਿੱਦਾਂ ਹੈਗਾ ਆਪਣਾ ਪੂਰਾ ਰੱਜ ਕੇ ਖਾਣਾ ਆਪਣੀ ਘਰ ਦੀ ਡਾਈਟ ਜੋ ਵੀ ਆ ਫਰੂਟਸ ਵਗੈਰਾ ਨਹੀਂ ਛੱਡਣੇ ਆਪਾਂ ਹਰੇਕ ਟਾਈਮ ਜਿਹੜੀ ਰੋਟੀ ਖਾਣੀ ਆ ਆਪਾਂ ਉਦੋਂ ਬਾਅਦ ਫਰੂਟ ਖਾਣੇ ਜ਼ਰੂਰ ਆ ਅਤੇ ਰੂਟੀਨ ਤਾਂ ਆਪਾਂ ਨੂੰ ਚਾਹੀਦੀ ਹੋਵੇਗੀ ਬਟ ਆਪਾਂ ਆਪਣੇ ਬਾਡੀ ਦੇ ਹਿਸਾਬ ਨਾਲ ਚੱਲਾਂਗੇ ਨਾ ਜੇ ਆਪਾਂ ਰੈਸਟ ਮੰਗਦੀ ਹੈ ਤਾਂ ਫਿਰ ਆਪਾਂ ਨੂੰ ਦੇਣੀ ਪਵੇਗੀ ਸਟਾਰਟਿੰਗ ਸਟਾਰਟਿੰਗ ਦੇ ਵਿੱਚ ਫਿਰ ਆਪਣੀ ਜਿੱਦਾਂ ਆਪਾਂ ਐਕਸਾਈਜ਼ ਕਰਦੇ ਰਹਾਂਗੇ ਬਾਡੀ ਉਹ ਚੀਜ਼ ਨੂੰ ਅਡੈਪਟ ਕਰੇਗੀ ਅਤੇ ਫਿਰ ਆਪਾਂ ਰੈਸਟ ਵਰਕਆਊਟ ਕਰ ਸਕਦੇ ਹਾਂ ਮੈਨੀਮਮ ਫੋਟੀ ਫਾਈਵ ਮਿੰਨਟਸ ਇੰਨਕਲੁਡਿੰਗ ਸਟੈਚਿੰਗ ਵਗੈਰਾ ਫੋਟੀ ਫਾਈਵ ਮਿੰਨਟਸ ਮਿਨੀਮਮ ਹੈਗਾ ਅਤੇ ਨਾਲ ਇਹਦੇ ਵਿੱਚ ਹੀ ਫੋਟੀ ਫਾਈਵ ਮਿੰਨਟਸ ਦੇ ਵਿੱਚ ਸਟੈਚਿੰਗ ਵਗੈਰਾ ਆ ਜਾਂਦੀ ਹੈ ਜਿਹੜੇ ਕਿ ਦਸ ਪੰਦਰਾਂ ਮਿੰਟ ਤਾਂ ਉਹਦੇ 'ਚ ਲੰਘ ਜਾਂਦੇ ਅਤੇ ਇਹ ਚੀਜ਼ ਹੁੰਦੀ ਹੈ ਹਾਂਜੀ ਹਾਂਜੀ ਪਰਸਨਲ ਪਰਸਨਲ ਟਰੇਨਿੰਗ ਜਿੱਦਾਂ ਹਜੇ ਸ਼ੁਰੂ ਕਰ ਸਕਦੇ ਹਾਂ ਆਪਾਂ ਤੁਸੀਂ ਪਹਿਲੇ ਕਲਾਇੰਟ ਹੋਵੋਂਗੇ ਅਤੇ ਟਾਈਮਿੰਗ ਵੈਸੇ ਫਿਰ ਲੇਟ ਹੋਵੇਗੀ ਸ਼ਾਮ ਦੀ ਹੋਵੇਗੀ ਸੱਤ ਤੋਂ ਅੱਠ ਚਲੋ ਠੀਕ ਆ ਜਿੱਦਾਂ ਤੁਹਾਨੂੰ ਠੀਕ ਲੱਗੇਗਾ ਅਤੇ ਸਤਿ ਸ਼੍ਰੀ ਅਕਾਲ